ਬਰਤਨ ਧੋਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਸਾਫ਼ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਅੱਛੇ ਡਿਸ਼ ਵੋਸ਼ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ ਤੇਲ ਵਾਲੇ ਬਰਤਨ ਨੂੰ ਸਾਫ਼ ਕਰਨ ਲਈ ਪਹਿਲਾਂ ਗਰਮ ਪਾਣੀ ਲੈਣਾ ਹੈ ਅਤੇ ਗਰਮ ਪਾਣੀ ਨਾਲ ਉਸ ਨੂੰ ਅੱਛੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤਾਂ ਜੋ ਉਸ ਦਾ ਗਰਮ ਪਾਣੀ ਨਾਲ ਉਸਦੀ ਚਿਕਨਾਹਟ ਤੇਲ ਸਭ ਨਿਕਲ ਜਾਏ ਅਤੇ ਉਸ ਤੋਂ ਬਾਅਦ ਇਸ ਨੂੰ ਡਿਸ਼ ਵੋਸ਼ ਜਾਂ ਕਿਸੀ ਵੀ ਸਰਫ ਸਾਬਣ ਨਾਲ ਅੱਛੀ ਤਰ੍ਹਾਂ ਵਾਸ਼ ਕਰਨਾ ਹੈ ਉਸ ਨੂੰ ਸਾਬਣ ਨਾਲ ਧੋਣ ਤੋਂ ਬਾਅਦ ਗਰਮ ਪਾਣੀ ਦੇ ਨਾਲ ਹੀ ਇਸ ਨੂੰ ਸਾਫ਼ ਕਰਨਾ ਹੈ ਇਸ ਕਰਕੇ ਸਾਡੇ ਬਰਤਨ ਵਿੱਚੋਂ ਸਾਰੀ ਤੇਲ ਦੀ ਚਿਕਨਾਹਟ ਗਰਮ ਪਾਣੀ ਰਾਹੀਂ ਨਿਕਲ ਜਾਵੇਗੀ ਅਤੇ ਉਹ ਬਿਲਕੁਲ ਸਾਫ਼ ਹੋ ਜਾਵੇਗਾ ਇਸ ਤੋਂ ਬਾਅਦ ਇਸ ਨੂੰ ਮੂਧਾ ਕਰਕੇ ਰੱਖ ਦੇਣਾ ਹੈ ਤਾਂ ਕਿ ਸਾਰਾ ਪਾਣੀ ਇਸ ਵਿੱਚੋਂ ਨਿਕਲ ਜਾਵੇ ਅਤੇ ਉਹ ਸੁੱਕ ਜਾਵੇ ਅਤੇ ਵਿੱਚੋਂ ਇਸਦੇ ਸਮੈਲ ਨਾ ਆਵੇ ਅਤੇ ਇਹ ਬਿਲਕੁਲ ਸਾਫ਼ ਹੋ ਜਾਵੇਗਾ ਇਸ ਤੋਂ ਬਾਅਦ ਇਸ ਨੂੰ ਆਪਣੇ ਬਰਤਨ ਰੱਖਣ ਵਾਲੇ ਸਟੈਂਡ ਵਿੱਚ ਜੋੜ ਦਿਓ